ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਪਹਿਲਾਂ ਤਾਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਮੈਂ ਤੁਹਾਡੇ ਜਨਮ ਦਿਨ 'ਤੇ ਦੋ ਟਿਕਟਾਂ ਸੀਗੀਆਂ ਦਿਲਜੀਤ ਦੁਸਾਂਝ ਦੇ ਕਨਸਰਟ ਦੀਆਂ ਉਹ ਖਰੀਦ ਲਈਆਂ ਸੀਗੀਆਂ ਜਿਹੜੀ ਕਿ ਆਪਾਂ ਨੂੰ ਵਧੀਆ ਡਿਸਕਾਊਂਟ ਦੇ ਅਧਾਰ 'ਤੇ ਮਿਲ ਗਈਆਂ ਸੀ ਅਤੇ ਮੈਂ ਚਾਹੁੰਦਾ ਹਾਂ ਵੀ ਆਪਾਂ ਦੋਵੇਂ ਤੁਹਾਡੇ ਜਨਮਦਿਨ ਦੇ ਉੱਤੇ ਜਾ ਕੇ ਦਿਲਜੀਤ ਦੁਸਾਂਝ ਦਾ ਜਿਹੜਾ ਕੰਸਰਟ ਆ ਉਹ ਸੁਣੀਏ ਅਤੇ ਆਪਣਾ ਜਿਹੜਾ ਤੁਹਾਡਾ ਜਨਮਦਿਨ ਆ ਉਹ ਵਧੀਆ ਤਰੀਕੇ ਦੇ ਨਾਲ ਮਨਾਈਏ ਕਿ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਜਨਮਦਿਨ ਹੈ ਅਤੇ ਆਪਾਂ ਨਾਲ ਦਿਲਜੀਤ ਦੁਸਾਂਝ ਜਿਹੜੇ ਸੌਂਗ ਨੇ ਉਹ ਸੁਣਾਂਗੇ ਅਤੇ ਨਾਲ ਭੰਗੜੇ ਪਾਵਾਂਗੇ ਅਤੇ ਤੁਹਾਡੇ ਵਧੀਆ ਤਰੀਕੇ ਨਾਲ ਜਨਮਦਿਨ ਉਹ ਮਨਾਵਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਔਫਰ ਆ ਉਹ ਪਸੰਦ ਆਇਆ ਹੋਵੇਗਾ ਅਤੇ ਆਪਾਂ ਜਲਦੀ ਹੀ ਮਿਲਦੇ ਹਾਂ